ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਬਹੁਤ ਸੰਸਥਾਵਾਂ ਹਨ ਜਿਹਨਾਂ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅ ਅਵਲ ਨੰਬਰ 'ਤੇ ਆਉਂਦੀ ਹੈ ਜੋ ਕਿ ਸਮੇਂ ਸਮੇਂ 'ਤੇ ਕਿਸਾਨਾਂ ਲਈ ਕਿਸਾਨ ਮੇਲੇ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਪਸ਼ੂ ਧਨ ਮੇਲੇ ਕਰਾਉਂਦੀ ਹੈ ਅਤੇ ਫਾਰਮਿੰਗ ਦੀਆਂ ਟਰੇਨਿੰਗਾਂ ਮੁਹੱਈਆ ਕਰਾਉਂਦੀਆਂ ਹਨ ਜਿਵੇਂ ਕਿ ਮਸ਼ਰੂਮ ਫਾਰਮਿੰਗ ਮੁਰਗੀ ਪਾਲਣ ਮੱਛੀ ਪਾਲਣ ਪਿੱਗ ਫਾਰਮਿੰਗ ਮਧੂ ਮੱਖੀ ਪਾਲਣ ਆਦਿ ਜੋ ਕਿ ਕਿਸਾਨੀ ਦੇ ਲਾਹੇਵੰਦ ਧੰਦੇ ਵਜੋਂ ਉੱਭਰ ਕੇ ਆਉਂਦੇ ਹਨ